ਪਸ਼ੂਆਂ ਵਿੱਚ ਵੱਖ ਵੱਖ ਬਿਮਾਰੀਆਂ ਲਈ ਵੱਖ ਵੱਖ ਟੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਅਫਾਰਾ ਹੋ ਜਾਂਦਾ ਹੈ ਉਹਨਾਂ ਨੂੰ ਕਿਸੇ ਕੀੜੇ ਮਕੌੜੇ ਦੇ ਖਾਣ ਪੀਣ ਨਾਲ ਚਾਰੇ ਦੇ ਵਿੱਚ ਕੀੜੇ ਮਕੌੜੇ ਖਾਧੇ ਜਾਣ ਦੇ ਨਾਲ ਉਹਨਾਂ ਨੂੰ ਢਿੱਡ ਵਿੱਚ ਅਫਵਾਰਾ ਹੋ ਜਾਂਦਾ ਹੈ ਉਸ ਕਰਕੇ ਟੀਕਾ ਲਗਾਇਆ ਜਾਂਦਾ ਹੈ ਦੂਸਰਾ ਬੁਖਾਰ ਦੇ ਵਾਸਤੇ ਵੀ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ ਔਰ ਉਹਨਾਂ ਦੇ ਸਰੀਰ 'ਤੇ ਚਿੱਚੜ ਜਿਵੇਂ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਦੇ ਮੂੰਹ ਖੋਰ ਦਾ ਟੀਕਾ ਵੀ ਲਗਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਇਨਫੈਕਸ਼ਨ ਅਤੇ ਸਿੰਗ ਠੋਕਣ ਵਾਸਤੇ ਵੀ ਟੀਕੇ ਲਗਾਏ ਜਾਂਦੇ ਹਨ ਔਰ ਬੱਚਿਆਂ ਦੀ ਪੈਦਾਵਾਰ ਵਾਸਤੇ ਵੀ ਉਹਨਾਂ ਨੂੰ ਗਾਵਾਂ ਮੱਝਾਂ ਨੂੰ ਟੀਕੇ ਲਗਾਏ ਜਾਂਦੇ ਹਨ ਇਸ ਤਰ੍ਹਾਂ ਅਨੇਕ ਹੋਰ ਵੀ ਬਿਮਾਰੀਆਂ ਕਾਰਨ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ ਧੰਨਵਾਦ